ਪਕਵਾਨ ਹਾਂਜੀ ਪਕਵਾਨ ਸ਼ਬਦ ਸੁਣਦੇ ਸਾਰ ਹੀ ਸਾਡੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਪਕਵਾਨ ਕਈ ਤਰ੍ਹਾਂ ਦੇ ਹੁੰਦੇ ਹਨ ਨਮਕੀਨ ਮਿੱਠੇ ਖੱਟੇ ਜਾਂ ਤਲੇ ਹੋਏ ਜਿਵੇਂ ਮਿੱਠੇ ਵਿੱਚ ਹਲਵਾ ਗਜਰੇਲਾ ਖੀਰ ਮਿੱਠੇ ਚੌਲ ਭਾਵ ਜਰਦਾ ਨਮਕੀਨ ਵਿੱਚ ਪਕੌੜੇ ਚਾਟ ਦਹੀਂ ਭੱਲੇ ਢੋਕਲਾ ਆਦਿ ਮੈਨੂੰ ਵੱਖ ਵੱਖ ਪਕਵਾਨ ਬਣਾਉਣ ਅਤੇ ਖਾਣ ਦਾ ਬਹੁਤ ਸ਼ੌਂਕ ਹੈ ਮੈਂ ਗਾਜਰ ਦਾ ਹਲਵਾ ਬਣਾਉਣ ਦੀ ਵਿਧੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਭ ਤੋਂ ਪਹਿਲਾਂ ਚੰਗੀਆਂ ਲਾਲ ਗਾਜਰਾਂ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਛਿਲ ਕੇ ਧੋ ਲਵੋ ਅਤੇ ਫਿਰ ਕੱਦੂਕਸ਼ ਕਰ ਲਵੋ ਫਿਰ ਉਸੇ ਗਾਜਰਾਂ ਨੂੰ ਖੁੱਲ੍ਹੇ ਭਾਂਡੇ ਵਿੱਚ ਦੁੱਧ ਪਾ ਕੇ ਚੰਗੀ ਤਰ੍ਹਾਂ ਉਬਾਲੋ ਗਾਜਰਾਂ ਨੂੰ ਉਬਾਲਣ ਦੀ ਕਿਰਿਆ ਵਿੱਚ ਕਾਫੀ ਸਮਾਂ ਲੱਗਦਾ ਹੈ ਕਿਉਂਕਿ ਜਿੰਨਾ ਦੁੱਧ ਪਾਇਆ ਹੋਵੇ ਉਸ ਵਿੱਚ ਗਾਜਰਾਂ ਨੂੰ ਚੰਗੀ ਤਰ੍ਹਾਂ ਕਾੜ੍ਹਨਾ ਹੁੰਦਾ ਹੈ ਫੇਰ ਇਸ ਵਿੱਚ ਸੁੱਕੇ ਮੇਵੇ ਕਾਜੂ ਬਦਾਮ ਕਿਸ਼ਮਿਸ਼ ਇਲਾਚੀ ਆਦਿ ਪਾ ਕੇ ਕੁਝ ਸਮਾਂ ਹੋਰ ਰਿੰਨੋ ਫੇਰ ਇਸ ਵਿੱਚ ਖੋਇਆ ਪਾ ਕੇ ਚੰਗੀ ਤਰ੍ਹਾਂ ਹਲਵੇ ਨੂੰ ਭੁੰਨੋ ਅਤੇ ਫੇਰ ਅਖੀਰ ਵਿੱਚ ਥੋੜ੍ਹਾ ਲੋੜ ਅਨੁਸਾਰ ਖੰਡ ਪਾ ਕੇ ਗਰਮ ਗਰਮ ਹਲਵਾ ਤਿਆਰ ਹੋ ਜਾਂਦਾ ਹੈ